ਮੈਂ ਮੀਸ਼ੋ ਤੋਂ ਆਪਣੇ ਲਈ ਇੱਕ ਟੋਪ ਔਡਰ ਕੀਤਾ ਸੀ ਉਹ ਟੋਪ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੀਸ਼ੋ ਦੇ ਪ੍ਰੋਡਕਟ ਦੀ ਕੁਆਲਿਟੀ ਵੀ ਮੈਨੂੰ ਬਹੁਤ ਵਧੀਆ ਲੱਗੀ ਜ ਜੋ ਵੀ ਸਰ ਮੈਨੂੰ ਇਹ ਪ੍ਰੋਡਕਟ ਦੇ ਕੇ ਗਏ ਉਹਨਾਂ ਨੇ ਉਹ ਪ੍ਰੋਡਕਟ ਮੈਨੂੰ ਮੇਰੇ ਘਰ ਤੱਕ ਪਹੁੰਚਾਇਆ ਉਹਨਾਂ ਦਾ ਬਿਹੇਵੀਅਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਨਹੀਂ ਤਾਂ ਆਮ ਹੀ ਲੋਕ ਆਉਂਦੇ ਨੇ ਪਰ ਉਹਨਾਂ ਦਾ ਬਿਹੇਵੀਅਰ ਕੁਝ ਠੀਕ ਨਹੀਂ ਹੁੰਦਾ ਵਿਵਹਾਰ ਉਹ ਲੋਕਾਂ ਨਾਲ ਵਧੀਆ ਨਹੀਂ ਕਰਦੇ ਪਰ ਮੀਸ਼ੋ ਤੋਂ ਜਿਹੜੇ ਸਰ ਮੈਨੂੰ ਇਹ ਪ੍ਰੋਡਕਟ ਦੇਣ ਆਏ ਉਹਨਾਂ ਦਾ ਬਿਹੇਵੀਅਰ ਬਹੁਤ ਹੀ ਜ਼ਿਆਦਾ ਵਧੀਆ ਸੀ ਇਹ ਪ੍ਰੋਡਕਟ ਮੈਨੂੰ ਬਹੁਤ ਪਸੰਦ ਆਇਆ ਜ ਜਿਵੇਂ ਦਾ ਮੈਨੂੰ ਇਹ ਟੋਪ ਚਾਹੀਦਾ ਸੀ ਉਵੇਂ ਦਾ ਹੀ ਮੈਨੂੰ ਮਿਲਿਆ ਉਵੇਂ ਦਾ ਹੀ ਕਲਰ ਮੈਨੂੰ ਮਿਲਿਆ ਅਤੇ ਸਹੀ ਟਾਈਮ 'ਤੇ ਪ੍ਰੋਡਕਟ ਮੇਰੇ ਕੋਲ ਪਹੁੰਚ ਗਿਆ ਇਸ ਲਈ ਮੈਂ ਮੀਸ਼ੋ ਤੋਂ ਹਰ ਵਾਰੀ ਔਡਰ ਬੁੱਕ ਕਰਦੀ ਹਾਂ ਚੀਜ਼ਾਂ ਲੈਂਦੀ ਹਾਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲਦੀਆਂ ਹਨ ਵਧੀਆ ਕੁਆਲਿਟੀ ਦੀਆਂ ਮਿਲਦੀਆਂ ਹਨ